ਕਿਤਾਬਾਂ ਤੋਂ ਇਲਾਵਾ ਮੈਂ ਬਹੁਤ ਸਾਰੇ ਮੈਗਜ਼ੀਨ ਅਖਬਾਰ ਪੜ੍ਹਦੀ ਹਾਂ ਜਿਨ੍ਹਾਂ ਦੇ ਵਿੱਚ ਮੈਨੂੰ ਜਿਹੜਾ ਕਰੰਟ ਅਫੇਅਰਸ ਦੇ ਵਿੱਚ ਕੀ ਚੱਲ ਰਿਹਾ ਜਾਣਨਾ ਬਹੁਤ ਵਧੀਆ ਲੱਗਦਾ ਮੈਨੂੰ ਪੋਲੀਟਿਕਸ ਦੇ ਵਿੱਚ ਜਿਵੇਂ ਬਹੁਤ ਇੰਟਰਸਟ ਹੋਣ ਦੇ ਕਰਕੇ ਮੈਨੂੰ ਰਹਿੰਦਾ ਹੈ ਕਿ ਪੋਲੀਟਿਕਸ ਦੇ ਬਾਰੇ ਜਾਣਾਂ ਵੀ ਚੱਲ ਕੀ ਰਿਹਾ ਇੰਡੀਆ ਦੇ ਵਿੱਚ ਕੀ ਚੱਲ ਰਿਹਾ ਜਾਂ ਇੰਡੀਆ ਤੋਂ ਬਾਹਰ ਕੀ ਚੱਲ ਰਿਹਾ ਤਾਂ ਮੈਨੂੰ ਇਹ ਚੀਜ਼ਾਂ ਪੜ੍ਹਨੀਆਂ ਵਧੀਆ ਲੱਗਦੀਆਂ ਨੇ ਅਖਬਾਰ ਦੇ ਵਿੱਚ ਹੈ ਨਾ ਪ੍ਰੈਜੈਂਟ ਨਾਲ ਟੱਚ ਰਹਿੰਦੇ ਹਾਂ ਵੀ ਆਪਣੇ ਆਲੇ ਦੁਆਲੇ ਹੋ ਕੀ ਰਿਹਾ ਉਹ ਚੀਜ਼ਾਂ ਵਧੀਆ ਲੱਗਦੀਆਂ ਨੇ ਮੈਗਜ਼ੀਨ ਦੇ ਵਿੱਚ ਕੀ ਟਰੈਂਡਸ ਚੱਲ ਰਹੇ ਨੇ ਕੀ ਫੈਸ਼ਨ ਹੈ ਕੀ ਮਤਲਬ ਐਗਰੀਕਲਚਰ ਦੇ ਵਿੱਚ ਕੋਈ ਨਵੀਂ ਅਪਡੇਟਸ ਆਈਆਂ ਨੇ ਨਵੇਂ ਨਵੇਂ ਜਨਰਲ ਪੜ੍ਹਨੇ ਮੈਨੂੰ ਚੰਗੇ ਲੱਗਦੇ ਹੈ ਤਾਂ ਮੈਂ ਇਨ ਇਹਨਾਂ ਬਾਰੇ ਪੜ੍ਹਦੀ ਹੀ ਰਹਿੰਦੀ ਹਾਂ ਵਲੋਗਸ ਜੋ ਅੱਜ ਕੱਲ੍ਹ ਮਤਲਬ ਔਨਲਾਈਨ ਆ ਰਹੇ ਨੇ ਉਹਨਾਂ ਬਾਰੇ ਵੀ ਮੈਂ ਬਹੁਤ ਪੜ੍ਹਦੀ ਹਾਂ ਕੋਈ ਆਪਣੇ ਕਿ ਸਟੱਡੀਸ ਉਹਦੇ ਉੱਤੇ ਦੱਸ ਰਿਹਾ ਜਾਂ ਫਿਰ ਅਖਬਾਰਾਂ ਦੇ ਵਿੱਚ ਆਪਣੀਆਂ ਕੋਈ ਆਰਟੀਕਲਸ ਛਾਪ ਰਿਹਾ ਜਿਹੜਾ ਕੁਛ ਬੰਦੇ ਨੇ ਐਕਸਪੀਰੀਅੰਸ ਕੀਤਾ ਹੁੰਦਾ ਹੈ ਨਾ ਲਾਈਫ ਦੇ ਵਿੱਚ ਉਹ ਆਪਣਾ ਪਬਲਿਸ਼ ਕਰ ਦਿੰਦਾ ਤਾਂ ਉਹ ਚੀਜ਼ਾਂ ਪੜ੍ਹਨੀਆਂ ਚੰਗੀਆਂ ਲੱਗਦੀਆਂ ਨੇ ਉਹਨਾਂ ਨਾਲ ਆਪ ਨੂੰ ਵੀ ਸਿੱਖਣ ਨੂੰ ਮਿਲਦਾ ਅਤੇ ਕਰੰਟ ਅਫੇਅਰਸ ਨਾਲ ਟੱਚ ਵੀ ਰਹਿੰਦੇ ਹਾਂ ਪਤਾ ਲੱਗਦਾ ਆਲੇ ਦੁਆਲੇ ਦਾ ਕੀ ਹੋ ਰਿਹਾ ਕੀ ਨਹੀਂ ਹੋ ਰਿਹਾ ਇਹ ਚੀਜ਼ਾਂ ਮੈਂ ਕੌਂਟੀਨਿਊ ਹੀ ਰੱਖਦੀ ਹਾਂ ਆਪਣੀ ਲਾਈਫ ਦੇ ਵਿੱਚ ਥੋੜ੍ਹਾ ਅਪਡੇਟ ਰਹਿੰਦੇ ਹਾਂ ਆਲੇ ਦੁਆਲੇ ਦੇ ਨਾਲ ਸੋ ਮੈਂ ਅਖਬਾਰ ਮੈਗਜ਼ੀਨ ਵਲੋਗ ਇਹ ਪੜ੍ਹਦੀ ਰਹਿੰਦੀ ਹਾਂ ਮੈਨੂੰ ਸ਼ੌਕ ਹੈ ਇਸਦਾ ਕਿਉਂਕਿ ਕਿਤਾਬਾਂ ਪੜ੍ਹਦੀ ਹਾਂ ਤਾਂ ਓਬਵੀਅਸ ਜਿਹੀ ਗੱਲ ਹੈ ਵੀ ਮੈਨੂੰ ਪੜ੍ਹਾਈ ਦੇ ਨਾਲ ਨਾਲ ਸਾਰੀਆਂ ਚੀਜ਼ਾਂ ਵਧੀਆ ਲੱਗਦੀਆਂ ਨੇ ਚਾਹੇ ਕੋਈ ਵੀ ਆ ਉਹ ਪੜ੍ਹਨਾ ਕੁਛ ਵੀ ਹੋਵੇ ਮੈਂ ਪੜ੍ਹਦੀ ਹਾਂ ਜ਼ਰੂਰ